ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਅੱਜ ਕੱਲ੍ਹ ਕਈਆਂ ਕਲਾਵਾਂ ਹਨ ਜੋ ਕਿ ਅਲੋਪ ਹੁੰਦੀਆ ਜਾ ਰਹੀਆਂ ਹਨ ਜਿਵੇਂ ਕਿ ਬਹੁਤ ਸਾਰੀਆਂ ਅਤੇ ਸਾਡੇ ਘਰ ਵਿੱਚ ਹੀ ਸਨ ਜੋ ਕਿ ਅਲੋਪ ਹੋ ਰਹੀਆਂ ਹਨ ਪਹਿਲਾਂ ਪਹਿਲਾਂ ਜਦੋਂ ਆਪਣੇ ਨਾਨੀ ਘਰ ਜਾਂਦਾ ਸੀ ਤਾਂ ਉਹ ਮੈਨੂੰ ਪਾਥੀਆਂ ਬਣਾ ਕੇ ਦਿਖਾਉਂਦੇ ਸੀ ਨਾਲ ਹੋਰ ਉਹ ਚੁੱਲ੍ਹੇ 'ਤੇ ਰੋਟੀ ਬਣਾਦੇ ਸਨ ਜੋ ਕਿ ਅੱਜ ਕੱਲ੍ਹ ਕਿਤੇ ਵੀ ਨਹੀਂ ਹੈ ਨਾ ਲੋਕ ਪਾਥੀਆਂ ਬਣਾਉਂਦੇ ਹਨ ਨਾ ਲੋਕ ਅੱਜ ਕੱਲ੍ਹ ਚੁੱਲ੍ਹੇ 'ਤੇ ਰੋਟੀ ਬਣਾਉਂਦੇ ਹਨ ਪਹਿਲਾਂ ਪਹਿਲਾਂ ਉਸ ਤੋਂ ਇਲਾਵਾ ਮੇਰੀ ਮੰਮਾ ਖੁਦ ਹੀ ਫੁਲਕਾਰੀਆਂ ਅਤੇ ਹੋਰ ਵੀ ਰੁਮਾਲਾਂ 'ਤੇ ਵੀ ਕਢਾਈ ਕਰਕੇ ਦਿਖਾਉਂਦੇ ਸਨ ਜੋ ਕਿ ਅੱਜ ਕੱਲ੍ਹ ਸਭ ਕੁਛ ਮਸ਼ੀਨੀ ਹੁੰਦਾ ਜਾ ਰਿਹਾ ਹੈ ਅਤੇ ਉਹ ਸਾਰੀਆਂ ਕਲਾਵਾਂ ਜੋ ਕਿ ਪਹਿਲਾਂ ਲੋਕਾਂ ਨੂੰ ਖੁਦ ਆਉਂਦੀਆਂ ਸੀ ਉਹ ਅੱਜ ਕੱਲ੍ਹ ਕਿਤੇ ਵੀ ਨਹੀਂ ਦਿੱਖ ਰਹੀਆਂ ਉਸ ਤੋਂ ਇਲਾਵਾ ਜੋ ਕੀ ਪਹਿਲਾਂ ਮਿੱਟੀ ਦੇ ਬਰਤਨ ਵਗੈਰਾ ਹੁੰਦੇ ਸੀ ਉਹ ਵੀ ਅੱਜ ਕੱਲ੍ਹ ਕੋਈ ਨਹੀਂ ਵਰਤਦਾ ਜਿਹਦੀ ਵਜ੍ਹਾ ਨਾਲ ਕਿ ਉਹਨਾਂ ਦੇ ਵੀ ਜੋ ਲੋਕ ਸੀ ਜਿਨ੍ਹਾਂ ਨੂੰ ਉਹ ਕਲਾਵਾਂ ਆਉਂਦੀਆਂ ਸੀ ਉਹ ਵੀ ਉਹ ਕਲਾਵਾਂ ਛੱਡ ਕੇ ਕੁਛ ਹੋਰ ਕੰਮ ਸ਼ੁਰੂ ਕਰ ਰਹੇ ਹਨ ਜੋ ਕਿ ਸਾਡੇ ਸਮਾਜ ਲਈ ਬਹੁਤ ਹੀ ਬੁਰਾ ਹੈ